ਸਾਡੇ ਖੇਤਰ ਵਿੱਚ ਡਾਕਟਰ ਮੌੜਾਂ ਵਾਲੇ ਦਾ ਹਸਪਤਾਲ ਹੈ ਉਹਦੇ ਵਿੱਚ ਸਾਨੂੰ ਪਹੁੰਚਣ ਵੇਲੇ ਥੋੜ੍ਹਾ ਦੂਰ ਲੱਗਦਾ ਥੋੜ੍ਹਾ ਜਿਹਾ ਦੂਰ ਕਰਕੇ ਸਾਨੂੰ ਮੁਸ਼ਕਿਲ ਆਉਂਦੀ ਹੈ ਵੈਸੇ ਉੱਥੋਂ ਦੀ ਮਤਲਬ ਕਿ ਉਹਨਾਂ ਦੀ ਜਿਹੜੀ ਮਰੀਜ਼ ਨੂੰ ਸਾਂਭਣ ਦੀ ਸਮਰੱਥਾ ਸਮਰੁਥਾ ਤਾਂ ਬਹੁਤ ਵਧੀਆ ਹੈਗੀ ਇੱਕ ਇੱਥੇ ਡਾਕਟਰ ਮਨਪ੍ਰੀਤ ਦਾ ਹਸਪਤਾਲ ਹੈ ਉੇੱਥੇ ਉਹਨਾਂ ਦਾ ਜਿਹੜਾ ਟਰੀਟਮੈਂਟ ਹੈ ਉਹਨਾਂ ਦਾ ਦੇਖਭਾਲ ਆ ਬਹੁਤ ਵਧੀਆ ਪਰ ਡਾਕਟਰ ਮਨਪ੍ਰੀਤ ਨਵੇਂ ਹੋਣ ਕਰਕੇ ਜ਼ਿਆਦਾਤਰ ਛੁੱਟੀ 'ਤੇ ਰਹਿੰਦੇ ਨੇ ਬਹੁਤ ਦੂਰੋਂ ਦੂਰੋਂ ਮਰੀਜ਼ ਆਉਂਦੇ ਨੇ ਉੱਥੇ ਜਦੋਂ ਉਹ ਆ ਵਿਚਾਰੇ ਆ ਕੇ ਚਾਰ ਚਾਰ ਪੰਜ ਪੰਜ ਘੰਟੇ ਬੈਠੇ ਰਹਿੰਦੇ ਨੇ ਮਿਲਦੇ ਨਹੀਂ ਫਿਰ ਵਾਪਸ ਚਲੇ ਜਾਂਦੇ ਨੇ ਇੱਕ ਸਾਡੇ ਡਾਕਟਰ ਕਪਲ ਆ ਜਿਹੜੇ ਕਿ ਬਹੁਤ ਪੁਰਾਣੇ ਡਾਕਟਰ ਨੇ ਬਹੁਤ ਜ਼ਿਆਦਾ ਉਹ ਫੈਮਲੀ ਡਾਕਟਰ ਵੀ ਨੇ ਆਲੇ ਦੁਆਲੇ ਦੇ ਆਪਣੇ ਜਿੰਨੇ ਵੀ ਨੇੜੇ ਦੇ ਉਹਨਾਂ ਦੇ ਘਰ ਨੇ ਸਾਰੇ ਘਰਾਂ ਦੇ ਵਿੱਚ ਜਿਵੇਂ ਬਜ਼ੁਰਗ ਜਿਹਨਾਂ ਨੂੰ ਲਿਆ ਨਹੀਂ ਸਕਦੇ ਹਸਪਤਾਲ ਦੇ ਵਿੱਚ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਨੇ ਇੱਕ ਬੰਦਾ ਰੱਖਿਆ ਹੋਇਆ ਘਰ ਜਾ ਕੇ ਵੀ ਉਹ ਟਰੀਟਮੈਂਟ ਕਰ ਆਉਂਦੇ ਨੇ ਕਈ ਵਾਰੀ ਉਹਨਾਂ ਦੇ ਹ ਹਸਪਤਾਲ ਦੇ ਵਿੱਚ ਸਾਨੂੰ ਮੁਸ਼ਕਿਲ ਇਹ ਆਉਂਦੀ ਹੈ ਕਿ ਉਹਨਾਂ ਦਾ ਹਸਪਤਾਲ ਥੋੜ੍ਹਾ ਛੋਟਾ ਹੋਣ ਕਰਕੇ ਉੱਥੇ ਮਰੀਜ਼ ਨੂੰ ਜ਼ਿਆਦਾ ਮਰੀਜ਼ ਦਾ ਦਾਖਲ ਨਹੀਂ ਕੀਤੇ ਜਾ ਸਕਦੇ ਕਈ ਵਾਰੀ ਬਹੁਤ ਜ਼ਿਆਦਾ ਸੀਰੀਅਸ ਮਰੀਜ਼ ਹੁੰਦਾ ਜਿਹਨੂੰ ਕਿ ਵੱਡੇ ਸ਼ਹਿਰ ਵਿੱਚ ਲੈ ਕੇ ਜਾਣਾ ਪੈਂਦਾ